ਪਾਣੀ ਨੂੰ ਫਿਲਟਰ ਕਰਨ ਲਈ ਅਲੱਗ ਅਲੱਗ ਏਰੀਏ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਨੇ ਜਿਵੇਂ ਕਿ ਗੱਲ ਕਰੀਏ ਤਾਂ ਘਰੇਲੂ ਨੁਸਖਿਆਂ ਦੀ ਘਰੇਲੂ ਨੁਸਖਿਆਂ ਵਿੱਚ ਜਿਵੇਂ ਕਿ ਘੜੇ ਨਾਲ ਘੜੇ ਦੁਆਰਾ ਫਿਲਟਰ ਵੀ ਚੱਲਦਾ ਸੀਗਾ ਅਤੇ ਇੱਕ ਦੇਸੀ ਜੁਗਾੜ ਵੀ ਬਣਾਏ ਹੋਏ ਸੀਗੇ ਲੋਕਾਂ ਨੇ ਉਹ ਵੀ ਚੱਲਦੇ ਹੁੰਦੇ ਸੀਗੇ ਜਿੱਦਾਂ ਕਿ ਪਾਣੀ ਨੂੰ ਇੱਕ ਜਗ੍ਹਾ ਰੱਖ ਲੈਣਾ ਫਿਰ ਉਹਦੇ ਵਿੱਚ ਜਿੰਨਾ ਵੀ ਉਹ ਮਿੱਟੀ ਵਗੈਰਾ ਘੱਟਾ ਹੁੰਦਾ ਸੀਗਾ ਉਹ ਥੱਲੇ ਬਹਿ ਜਾਂਦਾ ਸੀਗਾ ਉਸ ਤੋਂ ਬਾਅਦ ਉਹ ਜਿਹੜਾ ਪਾਣੀ ਬਚਦਾ ਸੀਗਾ ਉੱਪਰ ਉੱਪਰ ਵਾਲਾ ਸਾਫ ਪਾਣੀ ਅਤੇ ਉਹਨੂੰ ਫਿਰ ਨਾ ਉਬਾਲ ਕੇ ਉਹ ਪੀ ਵਗੈਰਾ ਲੈਂਦੇ ਸੀਗੇ ਇੱਦਾਂ ਵੀ ਹੁੰਦਾ ਸੀਗਾ ਅਤੇ ਇੱਕ ਲੋਕਾਂ ਨੇ ਦੇਸੀ ਫਿਲਟਰ ਬਣਾਏ ਹੋਏ ਸੀਗੇ ਉਹਦੇ ਵਿੱਚ ਨਾ ਉਹ ਤਿੰਨ ਘੜੇ ਲੈਂਦੇ ਸੀਗੇ ਤਿੰਨ ਘੜਿਆਂ ਵਿੱਚ ਸਭ ਤੋਂ ਪਹਿਲੇ ਘੜੇ ਵਿੱਚ ਹੁੰਦਾ ਸੀਗਾ ਜਿਹੜੇ ਬੜੇ ਬੜੇ ਪੱਥਰ ਹੁੰਦੇ ਸੀਗੇ ਉਹ ਹੁੰਦੇ ਸੀ ਉਸ ਤੋਂ ਬਾਅਦ ਫਿਰ ਛੋਟੇ ਪੱਥਰ ਆ ਜਾਂਦੇ ਸੀਗੇ ਛੋਟੇ ਪੱਥਰਾਂ ਤੋਂ ਬਾਅਦ ਅਤੇ ਆਪਣਾ ਰੇਤਾ ਆ ਜਾਂਦਾ ਸੀਗਾ ਰੇਤੇ ਤੋਂ ਬਾਅਦ ਕੋਲਾ ਆ ਜਾਂਦਾ ਸੀਗਾ ਕੋਲੇ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਉਹ ਮਤਲਬ ਕਿ ਕੱਪੜੇ ਜੇ ਟਾਈਪ ਵਛਾਇਆ ਹੁੰਦਾ ਸੀਗਾ ਉਹਨਾਂ ਨੇ ਅਤੇ ਉਸ ਤੋਂ ਬਾਅਦ ਫਿਰ ਆਹ ਆਪਣਾ ਅ ਬ ਹਲਕੇ ਹਲਕੇ ਜਿਹੜੇ ਛੋਟੇ ਛੋਟੇ ਬਰੀਕ ਬਰੀਕ ਪੱਥਰ ਹੁੰਦੇ ਨੇ ਉਹ ਆ ਜਾਂਦੇ ਆ ਅਤੇ ਇਹਦੇ ਰਾਹੀਂ ਘੜੇ ਦੇ ਰਾਹੀਂ ਇੱਕ ਘੜੇ ਦੇ ਰਾਹੀਂ ਦੂਜੇ ਘੜੇ 'ਚ ਆਉਂਦਾ ਫਿਰ ਪਾਣੀ ਦੂਜੇ ਤੋਂ ਤੀਜੇ 'ਚ ਤੀਜੇ ਤੋਂ ਚੌਥੇ 'ਚ ਅਤੇ ਇੱਦਾਂ ਉਹ ਸਾਰਾ ਪਾਣੀ ਫਿਲਟਰ ਹੋ ਕੇ ਉਹ ਸਾਡੇ ਕੋਲ ਪ੍ਰਾਪਤ ਹੋ ਜਾਂਦਾ ਵੈਸੇ ਅੱਜ ਕੱਲ੍ਹ ਜਿਹੜੇ ਉਹ ਹੈ ਘਰੇਲੂ ਅਤੇ ਨੁਸਖੇ ਇੰਨੇ ਕੰਮ ਨਹੀਂ ਆਉਂਦੇ ਕਿਉਂਕਿ ਪਾਣੀ ਵਿੱਚ ਬਹੁਤ ਸਾਰੇ ਬੈਕਟੀਰੀਆ ਖ ਮਤਲਬ ਕਿ ਇੱਦਾਂ ਦੇ ਤੱਤ ਆ ਗਏ ਨੇ ਕਿ ਜਿਹੜੇ ਮਤਲਬ ਸਾਡੇ ਪਾਣੀ ਖਰਾਬ ਕਰ ਰਹੇ ਨੇ ਕਿਉਂਕਿ ਸਾਡੇ ਏਰੀਏ ਵਿੱਚ ਫੈਕਟਰੀਆਂ ਬਹੁਤ ਨੇ ਜਿਹਨਾਂ ਕਰਕੇ ਸਾਡਾ ਪਾਣੀ ਹੈ ਜਿਹੜਾ ਦੂਸ਼ਿਤ ਹੁੰਦਾ ਜਾ ਰਿਹਾ ਅਤੇ ਹੁਣ ਜਿੰਨਾ ਵੀ ਹੁਣ ਕੰਮ ਹੋ ਰਹੇ ਨੇ ਉਹ ਸਾਰੇ ਜਿਹੜੇ ਆਧੁਨਿਕ ਫਿਲਟਰ ਨੇ ਉਹਨਾਂ ਰਾਹੀਂ ਸਾਰਾ ਪਾਣੀ ਫਿਲਟਰ ਹੋ ਰਿਹਾ ਹੈ